ਸਤਿ ਸ਼੍ਰੀ ਅਕਾਲ ਵੈਸੇ ਤਾਂ ਭਾਰਤ ਦੇਸ਼ ਬਹੁਤ ਵਿਭਿੰਨ ਪ੍ਰਾਂਤਾਂ ਦਾ ਹੈਗਾ ਤਾਂ ਹਰ ਪ੍ਰਾਂਤ ਵਿੱਚ ਅਲੱਗ ਅਲੱਗ ਤਿਉਹਾਰ ਬਣਾਏ ਜਾਂਦੇ ਆ ਅਤੇ ਉਸੇ ਤਿਉਹਾਰ ਦੇ ਆਧਾਰ 'ਤੇ ਅਲੱਗ ਅਲੱਗ ਚੀਜ਼ਾਂ ਪਕਾਈ ਜਾਂਦੀਆਂ ਜਿੱਦਾਂ ਕਿ ਮਿਠਾਈਆਂ ਤਿਉਹਾਰਾਂ 'ਤੇ ਵਿਸ਼ੇਸ਼ ਰੂਪ ਨਾਲ਼ ਮਿਠਾਈਆਂ ਬਣਾਈ ਜਾਂਦੀਆਂ ਜਿਵੇਂ ਕਿ ਲੱਡੂ ਬਰਫ਼ੀ ਗੁਜੀਆ ਜਲੇਬੀ ਅਤੇ ਗੁਲਾਬ ਜਾਮੁਨ ਪਕਵਾਨ ਹਰੇਕ ਤਿਉਹਾਰ ਦੀ ਆਪਣੀ ਵਿਸ਼ੇਸ਼ਤਾ ਦੀ ਵਜ੍ਹਾ ਨਾਲ਼ ਵਿਸ਼ੇਸ਼ ਪਕਵਾਨ ਬਣਾਏ ਜਾਂਦੇ ਆ ਜਿਵੇਂ ਕਿ ਸਮੋਸੇ ਜਲੇਬੀ ਦਿਵਾਲੀ 'ਤੇ ਪੂਰਨ ਪੋਲੀ ਅਤੇ ਗੁਜੀਆ ਹੋਲੀ 'ਤੇ ਪਕੌੜੇ ਨਵਰਾਤਰੇ 'ਤੇ ਅਤੇ ਆਪਣੇ ਪੰਜਾਬ ਵਿੱਚ ਜਿੱਦਾਂ ਕਿ ਲੋਹੜੀ 'ਤੇ ਸਰਸੋਂ ਦਾ ਸਾਗ ਮੱਕੀ ਦੀ ਰੋਟੀ ਅਤੇ ਲੰਗਰ ਦੀ ਦਾਲ ਰੋਟੀ ਵਿਸਾਖੀ 'ਤੇ ਲੋਹੜੀ 'ਤੇ ਤਿਲ ਗੁੜ ਦਿਵਾਲੀ 'ਤੇ ਬਰਫ਼ੀਆਂ ਅਤੇ ਵਿਸਾਖੀ 'ਤੇ ਪਿੰਨੀਆਂ ਵੀ ਬਣਾਈ ਜਾਂਦੀਆਂ ਤਿਉਹਾਰਾਂ ਦੇ ਆਧਾਰਿਤ 'ਤੇ ਲੋਕ ਬਹੁਤ ਸਾਰੇ ਚੀਜ਼ਾਂ ਬਣਾਉਂਦੇ ਆ ਕਈ ਲੋਕ ਵਿਸ਼ੇਸ਼ ਪੇ ਵੀ ਬਣਾਉਂਦੇ ਆ ਪੀਣ ਵਾਲੀ ਚੀਜ਼ਾਂ ਜਿਵੇਂ ਕਿ ਠੰਡਾਈ ਹੋਲੀ 'ਤੇ ਕੇਸਰ ਬਦਾਮ ਵਾਲਾ ਦੁੱਧ ਦਿਵਾਲੀ 'ਤੇ ਅਤੇ ਭੰਗ ਹੋਲੀ 'ਤੇ ਕਈ ਲੋਕ ਨਮਕੀਨ ਚੀਜ਼ਾਂ ਵੀ ਬਣਾਉਂਦੇ ਆ ਬਹੁਤ ਲੋਕਪ੍ਰਿਯ ਹੁੰਦੀਆਂ ਜਿਵੇਂ ਕਿ ਚੀਵੜਾ ਮਥੁਰੀ ਅਤੇ ਨਮਕਪਾਰੇ ਤਿਉਹਾਰਾਂ ਦੇ ਵਿਸ਼ੇਸ਼ ਰੂਪ ਨਾਲ਼ ਬਣਾਈ ਜਾਣ ਵਾਲੀ ਕਈ ਚੀਜ਼ਾਂ ਏ ਧੰਨਵਾਦ ਜੀ